ਮੈਂ ਮੋਹਾਲੀ ਜ਼ਿਲ੍ਹੇ ਵਿੱਚ ਰਹਿੰਦਾ ਹਾਂ ਜਿਸ ਦੇ ਨੇੜੇ ਚੰਡੀਗੜ੍ਹ ਪੈ ਜਾਂਦਾ ਹੈ ਜਿੱਥੇ ਕਿ ਘੁੰਮਣ ਫਿਰਨ ਲਈ ਬਹੁਤ ਹੀ ਸੋਹਣੀਆਂ ਸਥਾਨਾਂ ਹਨ ਜਿਵੇਂ ਕਿ ਸੁਖਨਾ ਝੀਲ ਚੰਡੀਗੜ੍ਹ ਅਤੇ ਰੋਜ਼ ਗਾਰਡਨ ਚੰਡੀਗੜ੍ਹ ਇੱਥੇ ਦੂਰੋਂ ਦੂਰੋਂ ਸੈਲਾਨੀ ਆਪਣੇ ਮਨ ਪ੍ਰਚਾਵੇ ਲਈ ਆਉਂਦੇ ਹਨ ਅਤੇ ਬਹੁਤ ਹੀ ਚੰਗਾ ਸਮਾਂ ਬਿਤਾ ਕੇ ਜਾਂਦੇ ਹਨ ਅਤੇ ਉਰੇ ਹੋਟਲਾਂ ਵਿੱਚ ਰਹਿੰਦੇ ਹਨ ਕਈ ਕਈ ਦਿਨ ਉਹ ਸਾਰਾ ਚੰਡੀਗੜ੍ਹ ਸ਼ਹਿਰ ਘੁੰਮਦੇ ਹਨ ਜੋ ਕਿ ਬਹੁਤ ਹੀ ਸੁੰਦਰ ਸ਼ਹਿਰ ਹੈ ਜਿਸ ਕਰ ਕੇ ਇਸ ਨੂੰ ਚੰਡੀਗੜ੍ਹ ਦਾ ਬਿਊਟੀਫੁੱਲ ਸਿਟੀ ਵੀ ਕਿਹਾ ਜਾਂਦਾ ਹੈ